ਬਾਗ ਦੇ ਬਿਸਤਰੇ ਵਾਸਤੇ ਸਾਨੂੰ ਉੱਚੇ ਲੰਮੇ ਅਤੇ ਮਜ਼ਬੂਤ ਪੌਦਿਆਂ ਦੀ ਜ਼ਰੂਰਤ ਹੁੰਦੀ ਹੈ ਜਿਵੇਂ ਕਿ ਟਾਹਲੀ ਇਹਨਾਂ ਪੌਦਿਆਂ ਉੱਪਰ ਆਪਣਾ ਬਿਸਤਰਾ ਅੱਛੀ ਤਰ੍ਹਾਂ ਬਣਾਇਆ ਜਾ ਸਕਦਾ ਹੈ ਤਾਂ ਜੋ ਹਨੇਰੀ ਆਉਣ ਦੇ ਕਾਰਨ ਕੋਈ ਨੁਕਸਾਨ ਨਾ ਹੋਵੇ ਜਾਂ ਉਸ ਜਗ੍ਹਾ 'ਤੇ ਜੋ ਰਾਖਾ ਬੈਠਾ ਹੈ ਉਸ ਦਿਨ ਨਿਗਰਾਨੀ ਸਾਰੇ ਪਾਸੇ ਰਹੇ ਉੱਚਾ ਹੋਣ ਦਾ ਕਾਰਨ ਇਹ ਹੈ ਮਜ਼ਬੂਤ ਅਤੇ ਟਿਕਾਊ ਬਿਸਤਰਾ ਲੱਗ ਜਾਂਦਾ ਹੈ ਬਿਸਤਰੇ ਨੂੰ ਅਸੀਂ ਅੱਛੀ ਤਰ੍ਹਾਂ ਇਸ ਤਰ੍ਹਾਂ ਟਿਕਾਉਂਦੇ ਹਾਂ ਤਾਂ ਜੋ ਕੋਈ ਨੁਕਸਾਨ ਨਾ ਹੋ ਸਕੇ ਬਿਸਤਰੇ ਲਈ ਸਾਨੂੰ ਮਜ਼ਬੂਤ ਅਤੇ ਟਿਕਾਊ ਪੌਦਿਆਂ ਦੀ ਹੀ ਲੋੜ ਹੁੰਦੀ ਹੈ ਇਸ ਲਈ ਅਸੀਂ ਇਹ ਫੈਸਲਾ ਕਰਦੇ ਹਾਂ ਕਿ ਸਾਨੂੰ ਬਾਗ ਦੇ ਬਿਸਤਰੇ ਲਈ ਉੱਚੇ ਲੰਮੇ ਅਤੇ ਮਜ਼ਬੂਤ ਪੌਦਿਆਂ ਦੀ ਹੀ ਜ਼ਰੂਰਤ ਹੁੰਦੀ ਹੈ